ਟਰੈਕਿੰਗ ਵਿੱਚ ਵੈਸੇ ਤਾਂ ਮੈਂ ਜ਼ਿਆਦਾਤਰ ਖਾਸ ਮ ਅਨੁਭਵ ਖਰਾਬ ਮੌਸਮ ਦਾ ਅਨੁਭਵ ਜ਼ਿਆਦਾ ਨਹੀਂ ਕੀਤਾ ਵੈਸੇ ਥੋੜ੍ਹਾ ਥੋ ਮਤਲਬ ਕਿ ਸਾਲ ਕੁ ਹੀ ਹੋ ਗਿਆ ਮੈਨੂੰ ਲੱਗਦਾ ਮੈਂ ਉਦੋਂ ਗਿਆ ਹੋਇਆ ਸੀਗਾ ਕੁੱਲੂ ਮਨਾਲੀ ਵੱਲ ਉਦੋਂ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਬਰਫ ਬਹੁਤ ਪੈ ਰਹੀ ਸੀਗੀ ਅਤੇ ਗੱਡੀਆਂ ਵਗੈਰਾ ਵੀ ਜਿਹੜੀਆਂ ਸੀਗੀਆਂ ਉਹ ਆਉਣੀਆਂ ਜਾਣੀਆਂ ਬੰਦ ਹੋ ਗਈਆਂ ਸੀਗੀਆਂ ਅਤੇ ਜਿਹੜੀਆਂ ਉੱਥੇ ਸੀਗੇ ਲੋਕ ਉੱਥੇ ਹੀ ਫਸੇ ਹੋਏ ਰਹਿ ਗਏ ਸੀਗੇ ਅਤੇ ਉਹ ਹਫਤਾ ਮਤਲਬ ਕਿ ਪੂਰੀ ਮਤਲਬ ਕਿ ਪੂਰੀ ਬਰਫ ਪਈ ਬਰਫਬਾਰੀ ਨਾਲ ਨਾ ਸਾਡਾ ਮਤਲਬ ਕਿ ਉੱਥੇ ਦੇ ਜਿਹੜੇ ਲ ਹ ਲੋਕਲ ਲੋਕ ਸੀਗੇ ਉਹਨਾਂ ਨੇ ਵੀ ਆਪਣਾ ਖਾਣ ਪੀਣ ਵਾਲਾ ਸਮਾਨ ਵੀ ਬਹੁਤ ਜ਼ਿਆਦਾ ਉੱਚੇ ਦਾਮ 'ਤੇ ਮਤਲਬ ਵੇਚਣਾ ਸ਼ੁਰੂ ਕਰ ਦਿੱਤਾ ਫਿਰ ਇਵੇਂ ਹੀ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਟਰੈਕਿੰਗ ਦੌਰਾਨ ਜਿਹੜੀਆਂ ਅਸੀਂ ਆਮ ਤੌਰ 'ਤੇ ਦਵਾਈਆਂ ਰੱਖਦੇ ਹਾਂ ਜਿੱਦਾਂ ਕਿ ਬੁਖਾਰ ਦੀ ਹੋ ਗਈ ਕੋਈ ਥਕਾਵਟ ਲਈ ਹੋ ਗਈ ਉਲਟੀਆਂ ਲਈ ਹੋ ਗਈ ਇੱਦਾਂ ਦੀਆਂ ਜਿਹੜੀਆਂ ਸਾਨੂੰ ਮਤਲਬ ਕਿ ਲੋਕਲ ਨੋਰਮਲ ਦਵਾਈਆਂ ਹੁੰਦੀਆਂ ਨੇ ਜਿਹੜੀਆਂ ਲੋੜ ਪੈ ਜਾਂਦੀ ਹੈ ਉਹ ਸਾਰੀਆਂ ਸਾਨੂੰ ਚਾਹੀਦੀਆਂ ਹੁੰਦੀਆਂ ਨੇ